ਹੈਲੋ ਹਾਂਜੀ ਅੱਛਾ ਜੀ ਨਹੀਂ ਸਾਡੇ ਇੱਥੇ ਹਰ ਤਰ੍ਹਾਂ ਦੀ ਚਾਹ ਮਿਲ ਜਾਂਦੀ ਹੈ ਤੁਸੀਂ ਕਿਸ ਤਰ੍ਹਾਂ ਦੀ ਚਾਹ ਚਾਹੁੰਦੇ ਹੋ ਚਾਹ ਚਾਹੁੰਦੇ ਹੋ ਤੁਸੀਂ ਸਾਡੇ ਤੋਂ ਕਿਸ ਤਰ੍ਹਾਂ ਦੀ ਚਾਹ ਬਣਵਾਉਣਾ ਚਾਹੁੰਦੇ ਹੋ ਸਾਨੂੰ ਦੱਸ ਸਕਦੇ ਹੋ ਸਾਡੇ ਕੋਲੋਂ ਤੁਹਾਨੂੰ ਸ਼ੂਗਰ ਫਰੀ ਚਾਹ ਵੀ ਮਿਲਜੂਗੀ ਅਤੇ ਬਲੈਕ ਟੀ ਵੀ ਮਿਲਜੂਗੀ ਅਤੇ ਗਰੀਨ ਟੀ ਵੀ ਮਿਲਜੂਗੀ ਅਤੇ ਅਸੀਂ ਅਜਵਾਈਨ ਵਾਲੀ ਵੀ ਚਾਹ ਬਣਾਉਂਦੇ ਹਾਂ ਅਤੇ ਇਲਾਚੀ ਵਾਲੀ ਵੀ ਸਾਡੀ ਚਾਹ ਅਲਗ ਤੋਂ ਬਣਦੀ ਨੇ ਤੁਸੀਂ ਦੱਸੋ ਕਿਹੜੀ ਚਾਹ ਪੀਣਾ ਪਸੰਦ ਕਰੋਗੇ ਔਰ ਕਿਸ ਚਾਹ ਦਾ ਤੁਸੀਂ ਅਸੀਂ ਕਾਫੀ ਵਾਲੀ ਜਿਹੜੀ ਚਾਹ ਹੈ ਉਹ ਸਾਡੀ ਥੋੜ੍ਹੀ ਜਿਹੀ ਵੱਧ ਨੇ ਵੱਧ ਰੇਟ ਨੇ ਉਹਦਾ ਸਾਡਾ ਤੀਹ ਰੁਪਏ ਕੱਪ ਹੈ ਅਤੇ ਜਿਹੜੀ ਸਿੰਪਲ ਚਾਹ ਏ ਉਹ ਸਾਡਾ ਦਸ ਰੁਪਏ ਕੱਪ ਏ ਅਤੇ ਜਿਹੜੀ ਅਸੀਂ ਇਲਾਚੀ ਵਾਲੀ ਅਤੇ ਤੁਲਸੀ ਵਾਲੀ ਚਾਹ ਅਤੇ ਅਦਰਕ ਵਾਲੀ ਜਿਹੜੀ ਚਾਹ ਅਸੀਂ ਬਣਾਉਂਦੇ ਹਾਂ ਉਸ ਦੇ ਰੇਟ ਸਾਡੇ ਪੰਦਰਾਂ ਰੁਪਈਏ ਰੱਖੇ ਗਏ ਨੇ ਅਤੇ ਤੁਸੀਂ ਕਿਹੜੀ ਚਾਹ ਪੀਣਾ ਪਸੰਦ ਕਰੋਗੇ ਉਸ ਬਾਰੇ ਤੁਸੀਂ ਸਾਨੂੰ ਦੱਸ ਸਕਦੇ ਹੋ ਚਾਹ ਦੇ ਨਾਲ ਅਸੀਂ ਇੱਕ ਤਾਂ ਬ੍ਰਿਟੈਨੀਆ ਬਿਸਕੁਟ ਵੀ ਰੱਖੇ ਹੋਏ ਆ ਇੱਕ ਰਸ ਵੀ ਹੈ ਅਤੇ ਅਸੀਂ ਚਾਹ ਦੇ ਨਾਲ ਤੁਹਾਨੂੰ ਸਨੈਕਸ ਵੀ ਦੇ ਸਕਦੇ ਹਾਂ ਅਗਰ ਤੁਹਾਨੂੰ ਕੋਈ ਹੋਰ ਚੀਜ਼ ਪਸੰਦ ਹੈ ਤਾਂ ਸਾਨੂੰ ਉਸ ਤਰ੍ਹਾਂ ਦੱਸ ਸਕਦੇ ਹੋ ਅਸੀਂ ਉਹ ਵੀ ਤੁਹਾਨੂੰ ਔਡ ਅਪਲਾਈ ਕਰ ਦੇਵਾਂਗੇ ਚਾਹ ਚਾਹ ਦੇ ਨਾਲ ਅਤੇ ਅਸੀਂ ਮਿੱਠੇ ਬਿਸਕੂਟ ਗੁੜ ਵਾਲੇ ਬਿਸਕੁਟ ਅਤੇ ਹੋਰ ਤੁਸੀਂ ਕਿਹੜੀ ਚੀਜ਼ ਨਾਲ ਰੱਖਣਾ ਚਾਨ ਲੈਣਾ ਚਾਹੁੰਦੇ ਸਾਨੂੰ ਦੱਸ ਸਕਦੇ ਹੋ ਠੀਕ ਹੈ ਜੀ ਸਾਡੀ ਵੈਸੇ ਤੁਸੀਂ ਸਾਨੂੰ ਦੱਸ ਸਕਦੇ ਹੋ ਵੀ ਤੁਹਾਨੂੰ ਕਿਹੜੀ ਕਿਹੜੀ ਚਾਹ ਚਾਹੀਦੀ ਹੈ ਅਸੀਂ ਉਸ ਹਿਸਾਬ ਨਾਲ ਤੁਹਾਨੂੰ ਔਰਡਰ ਟਾਈਮ 'ਤੇ ਪਹੁੰਚਾ ਦਾਂਗੇ ਅਤੇ ਅਸੀਂ ਬਣਾ ਕੇ ਤੁਹਾਨੂੰ ਦੱਸ ਦਾਂਗੇ ਅਤੇ ਤੁਹਾਨੂੰ ਆਪ ਹੀ ਸਾਡੇ ਕੋਲੋਂ ਆ ਕੇ ਲੈ ਕੇ ਜਾਣੇ ਪਊਗੀ ਅਤੇ ਚਾਹ ਦੇ ਵਿੱਚ ਅਸੀਂ ਤੁਹਾਨੂੰ ਵਧੀਆ ਬਣਾ ਕੇ ਦੇਵਾਂਗੇ ਤੁਹਾਨੂੰ ਇੱਥੇ ਤੁਸੀਂ ਆ ਕੇ ਟਰਾਈ ਕਰਕੇ ਲੈਜ ਪੀ ਕੇ ਦੇਖ ਲਿਓ ਅਗਰ ਤੁਹਾਨੂੰ ਕੋਈ ਲੱਗਿਆ ਬਈ ਕੋਈ ਮਿਸਟੇਕ ਆ ਸਾਨੂੰ ਦੱਸ ਦਿਓ ਅਸੀਂ ਉਹਨੂੰ ਸਹੀ ਕਰਾਂਗੇ ਅਤੇ ਤੁਹਾਨੂੰ ਤੁਹਾਡੇ ਪਸੰਦ ਦੀ ਚਾਹ ਦਾ ਅਸੀਂ ਆਰਡਰ ਕਰਾਂਗੇ ਹਾਂਜੀ ਕੋਈ ਗੱਲ ਨਹੀਂ ਜੀ ਚਾਹ ਦੇ ਵਿੱਚ ਅਸੀਂ ਜਿਹੜੇ ਜਿਹੜੇ ਬਿਸਕੁਟ ਰੱਖੇ ਆ ਉਸ ਤੋਂ ਇਲਾਵਾ ਅਗਰ ਤੁਹਾਨੂੰ ਕੋਈ ਹੋਰ ਚੀਜ਼ ਚਾਹੀਦੀ ਹੈ ਤਾਂ ਤੁਸੀਂ ਸਾਨੂੰ ਉਹ ਵੀ ਦੱਸ ਸਕਦੇ ਹੋ ਅਸੀਂ ਉਹ ਆਰਡਰ ਵੀ ਤੁਹਾਡਾ ਅਸੀਂ ਪੂਰਾ ਕਰ ਸਕਦੇ ਹਾਂ ਅਤੇ ਇਸ ਤੋਂ ਅਗਰ ਇਲਾਵਾ ਤੁਹਾਨੂੰ ਕੋਈ ਹੋਰ ਚੀਜ਼ ਚਾਹੀਦੀ ਸਾਨੂੰ ਤੁਸੀਂ ਉਹ ਵੀ ਦੱਸ ਸਕਦੇ ਹੋ ਓਕੇ ਠੀਕ ਹੈ ਜੀ